ਮੈਂ ਨੈਨਸੀ ਅਸੀਂ ਖਾਣਾ ਬਣਾਉਂਦੇ ਹਾਂ ਮਜ਼ਦੂਰੀ ਕਰਦੇ ਹਾਂ ਅਸੀਂ ਆਪਣਾ ਕੰਮ ਆਪਣੇ ਹੱਥੀਂ ਕਰਦੇ ਹਾਂ ਸਾਡੇ ਵੱਡੇ ਬਜ਼ੁਰਗ ਸਾਨੂੰ ਇਹ ਸਿਖਾਉਂਦੇ ਨੇ ਕਿ ਸਾਨੂੰ ਆਪਣਾ ਕੰਮ ਆਪਣੇ ਹੱਥੀਂ ਕਰਨਾ ਚਾਹੀਦਾ ਹੈ ਮੇਰੇ ਦਾਦਾ ਜੀ ਅਤੇ ਦਾਦੀ ਜੀ ਸਾਨੂੰ ਇਹ ਕਹਿੰਦੇ ਨੇ ਕਿ ਸਾਨੂੰ ਆਪਣਾ ਕੰਮ ਆਪ ਹੀ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਡੇ ਘਰ ਮੱਝਾਂ ਨੇ ਉਹਨਾਂ ਦੀ ਦੇਖਭਾਲ ਸਾਨੂੰ ਆਪਣੇ ਹੱਥੀਂ ਕਰਨੀ ਚਾਹੀਦੀ ਹੈ ਸਾਡੇ ਘਰ ਵਿੱਚ ਲੱਸੀ ਤੋਂ ਮੱਖਣ ਆਪਣੇ ਹੱਥੀਂ ਕੱਢੇ ਕੱਢਦੇ ਹਾਂ ਇਹ ਸਾਡਾ ਪੰਜਾਬੀ ਕਲਚਰ ਹੈ ਜਿਹੜਾ ਸਾਡਾ ਹੱਥੀਂ ਕੰਮ ਹੁੰਦਾ ਹੈ ਉਹ ਸਾਡਾ ਵਪਾਰ ਹੁੰਦਾ ਹੈ